ਹਾਂਜੀ ਚਾਰ ਪੰਜ ਦਿਨ ਹੋ ਗਏ ਨਾ ਉਹ ਮੇਰਾ ਬਹੁਤ ਜ਼ਿਆਦਾ ਦਰਦ ਹੋਇਆ ਇਹਦਾ ਇੰਨਾ ਜ਼ਿਆਦਾ ਬਈ ਉਮਰ ਮੈਂ ਕਿਹਾ ਚਲੋ ਉਮਰ ਵੱਡੀ ਹੋਈ ਜਾਂਦੀ ਆ ਚਾਲੀ ਪਲੱਸ ਹੋਈ ਪਏ ਹਾਂ ਦਰਦ ਹੋਈ ਜਾਂਦਾ ਕੀ ਕਾਰਨ ਹੋਇਆ ਚਲੋ ਮੈਂ ਹਸਪਤਾਲ ਦੇ ਵਿੱਚ ਗਿਆ ਜੀ ਅਤੇ ਉਹਨਾਂ ਨੇ ਮੈਨੂੰ ਫਟਾਫਟ ਆਡਮਿਟ ਕੀਤਾ ਉਹ ਕਹਿੰਦੇ ਅਪਰੇਟ ਕਰਨਾ ਪਊਗਾ ਤੁਹਾਡੇ ਤਾਂ ਕਹਿੰਦੇ ਕਿਡਨੀ ਦੇ ਵਿੱਚ ਬਹੁਤ ਸਾਰੀਆਂ ਪਥਰੀਆਂ ਦੇ ਨਾਲ ਭਰਿਆ ਪਿਆ ਹੈਗਾ ਵੀ ਐਟ ਏ ਟੈਮ ਤੁਹਾਡਾ ਤਾਂ ਅਪਰੇਟ ਕਰਨਾ ਪਊਗਾ ਤਾਂ ਉਸ ਵਕਤ ਤਾਂ ਨਾ ਜਿਹੜਾ ਮੇਰੇ ਕੋਲ ਪੈਸਿਆਂ ਦੀ ਘਾਟ ਸੀਗੀ ਅਤੇ ਮੈਂ ਸੋਚਿਆ ਵੀ ਹੁਣ ਕਿਵੇਂ ਕੀਤਾ ਜਾਵੇ ਕਿਹਤੋਂ ਮੰਗਾਂਗੇ ਆਪਾਂ ਪੈਸੇ ਤਾਂ ਉਹਦੇ ਲਈ ਕੀ ਹੈ ਨਾ ਫਿਰ ਮੈਂ ਨਾ ਆਪਦਾ ਜਿਹੜਾ ਬੀਮਾ ਸੀ ਮੈਂ ਕਿਹਾ ਵੀ ਇਹਨੂੰ ਚੈੱਕ ਕਰਾਂ ਮੇਰਾ ਜਿਹੜਾ ਹੈਲਥ ਇਨ ਇੰਸ਼ੋਰੈਂਸ ਕਰਵਾਇਆ ਵੇ ਹੈਗਾ ਕਿ ਜਿਹੜਾ ਉਹ ਮੇਰੀ ਬਿਮਾਰੀ ਨੂੰ ਇਸ ਇਲਾਜ ਨੂੰ ਕਵਰ ਕਰਦਾ ਕਿ ਨਹੀਂ ਕਰਦਾ ਫਿਰ ਮੈਂ ਜਦੋਂ ਮੈਨੂੰ ਥੋੜ੍ਹਾ ਹਲਕਾ ਜਿਹਾ ਮੈਂ ਫੀਲ ਮਹਿਸੂਸ ਕੀਤਾ ਨਾ ਤਾਂ ਆਪਾਂ ਜਿਹੜਾ ਕਿ ਮੈਂ ਆਪਦੀ ਵੈਬਸਾਈਟ ਨੂੰ ਖੋਲ੍ਹ ਕੇ ਮੈਂ ਚੈੱਕ ਕੀਤਾ ਵੀ ਜਿਹੜਾ ਕਿ ਇਹਦੇ ਲਈ ਮੈਂ ਜਿਹੜਾ ਅਪਰੇਟ ਮੈਂ ਕਰਵਾ ਸਕਦਾ ਜਿਹੜਾ ਮੇਰਾ ਬੀਮਾ ਕਵਾਇਆ ਵੇ ਹੈ ਹੈਲਥ ਇੰਸ਼ੋਰੈਂਸ ਕਰਵਾਇਆ ਵੇ ਹੈਗਾ ਕਿ ਜਿਹੜਾ ਮੇਰਾ ਅਪਰੇਟ ਹੈ ਇਹਦੇ ਲਈ ਵੈਲਿਡ ਹੈ ਜਾਂ ਨਹੀਂ ਜਾਂ ਮੈਨੂੰ ਕੁਛ ਕਰਨਾ ਪਊ ਤਾਂ ਜਦੋਂ ਇਹਨੂੰ ਮੈਂ ਖੋਲ੍ਹਿਆ ਆਪਣੀ ਮੈਂ ਗੂਗਲ ਕਰੋਮ ਖੋਲ੍ਹਿਆ ਉਹਦੇ 'ਚ ਹੈਲਥ ਬੀਮਾ ਖੋਲ੍ਹ ਕੇ ਉਸ ਤੋਂ ਬਾਅਦ ਕੀ ਹੈ ਮੈਂ ਉਹਨੂੰ ਲੋਗਇਨ ਕੀਤਾ ਤਾਂ ਉਹਦੇ ਵਿੱਚ ਮੈਂ ਦੇਖਿਆ ਕਿ ਜਿਹੜਾ ਮੇਰਾ ਜਿਹੜੀ ਸਰਜਰੀ ਮੈਂ ਕਰਵਾਉਣੀ ਸੀ ਉਹਦੇ ਵਿੱਚ ਸੀ ਤਾਂ ਉਹ ਮੈਂ ਕਰਵਾ ਸਕਦਾ ਸੀਗਾ ਅਤੇ ਫਿਰ ਮੈਂ ਉਹ ਉੱਥੋਂ ਦੇ ਸਟਾਫ ਨੂੰ ਕਿਹਾ ਵੀ ਹਾਂਜੀ ਤੁਸੀਂ ਮੇਰਾ ਜਿਹੜਾ ਕੀ ਅਪਰੇਟ ਕਰ ਦਿਓ ਵੀ ਜਿਹੜਾ ਮੇਰਾ ਬੀਮਾ ਮੇਰਾ ਕਰਵਾਇਆ ਵੇ ਹੈ ਹੈਲਥ ਇਸ਼ੋਰੈਂਸ ਮੇਰਾ ਹੋਇਆ ਵੇ ਹੈਗਾ ਅਤੇ ਉਹੀ ਜਿਹੜਾ ਮੇਰੇ ਬਿਲਾਂ ਦਾ ਭੁਗਤਾਨ ਕਰੂਗਾ ਤਾਂ ਇਹ ਮੈਨੂੰ ਬਹੁਤ ਠੀਕ ਲੱਗਿਆ ਕਿਉਂਕਿ ਜੇ ਬਿਮਾਰੀ ਤਾਂ ਬੰਦੇ 'ਤੇ ਕਦੇ ਵੀ ਆ ਸਕਦੀ ਹੈਗੀ ਹੋ ਸਕਦਾ ਆਪਣੇ ਕੋਲ ਉਦੋਂ ਪੈਸੇ ਨਾ ਹੋਣ ਨਾ ਜੇ ਆਪਣਾ ਬੀਮਾ ਕਰਵਾਇਆ ਹੋਇਆ ਹੁੰਦਾ ਤਾਂ ਆਪਾਂ ਨੂੰ ਇਲਾਜ ਕਰਾਉਣਾ ਸੌਖਾ ਹੋ ਜਾਂਦਾ ਅਤੇ ਮੈਂ ਤਾਂ ਦੇਖੋ ਸਾਰਿਆਂ ਨੂੰ ਇਹੀ ਸਲਾਹ ਹੀ ਦੇ ਸਲਾਹ ਦਿੰਦਾ ਭਾਈ ਸਾਰਿਆਂ ਨੂੰ ਹੀ ਆਪਾਂ ਨੂੰ ਸਿਹਤ ਦਾ ਬੀਮਾ ਕਰਵਾਉਣਾ ਚਾਹੀਦਾ ਹੈਗਾ ਠੀਕ ਆ ਅਤੇ ਆਪਾਂ ਨੂੰ ਦਵਾਈ ਦੁਵਈ ਦੇ ਖਰਚੇ ਨਾ ਵਧੀਆ ਨਿਕਲ ਜਾਂਦੇ ਹੈਗੇ ਠੀਕ ਹੈ ਧੰਨਵਾਦ ਜੀ